ਹਰ ਸਾਲ ਸਰਕਾਰ ਬਹੁਤ ਸਾਰੀਆਂ ਸਕੀਮਾਂ ਕੱਢਦੀ ਹੈ ਕਈਆਂ ਦਾ ਫਾਇਦਾ ਲੋਕਾਂ ਨੂੰ ਹੁੰਦਾ ਅਤੇ ਕਈ ਕ ਵਾਰ ਲੋਕਾਂ ਨੂੰ ਉਸਦਾ ਨੈਗਟਿਵ ਇੰਪੈਕਟ ਵੀ ਮਿਲਦਾ ਜਿਵੇਂ ਆਪਾਂ ਪੋਜੀਟਿਵ ਵਾਲੇ ਪਾਸੇ ਜਾਈਏ ਅਤੇ ਪੜ੍ਹਨ ਵਾਲੇ ਬੱਚਿਆਂ ਵਾਸਤੇ ਦਸਵੀਂ ਬਾਰ੍ਹਵੀਂ ਜਾਂ ਯੂਨੀਵਰਸਿਟੀ 'ਚ ਪੜ੍ਹਨ ਵਾਲੇ ਕਾਲਜਾਂ 'ਚ ਪੜ੍ਹਨ ਵਾਲੇ ਬੱਚਿਆਂ ਵਾਸਤੇ ਸਰਕਾਰ ਨੇ ਸਕਾਲਰਸ਼ਿਪ ਸਕੀਮ ਚਲਾਈ ਹੋਈ ਹੈ ਡਾਕਟਰ ਅੰਬੇਦਕਰ ਸਕਾਲਰਸ਼ਿਪ ਸਕੀਮ ਜਿਹੜੀ ਕਿ ਪੰਜਾਬ ਵਿੱਚ ਸਰਕਾਰੀ ਸਕਾਲਰਸ਼ਿਪ ਲੈਣ ਵਾਸਤੇ ਇਹ ਸਕੀਮ ਬਣੀ ਹੋਈ ਹੈ ਇਸ ਦੁਆਰਾ ਬੜੇ ਬਹੁਤ ਬੱਚਿਆਂ ਨੂੰ ਫਾਇਦਾ ਪ੍ਰਾਪਤ ਹੁੰਦਾ ਕਿਉਂਕਿ ਕਈ ਬੱਚੇ ਫੀਸ ਦੇਣ ਦੇ ਯੋਗ ਨਹੀਂ ਹੁੰਦੇ ਜਾਂ ਉਹਨਾਂ ਦੇ ਘਰ ਦੇ ਇੰਨੇ ਯੋਗ ਨਹੀਂ ਹੁੰਦੇ ਕਿ ਉਹ ਉਹਨਾਂ ਦੀ ਪੂਰੀ ਫੀਸ ਭਰ ਸਕਣ ਇਸ ਕਰਕੇ ਸਰਕਾਰ ਉਹਨਾਂ ਦੀ ਫੀਸ ਖੁਦ ਦਿੰਦੀ ਹੈ ਜਾਂ ਉਹਨਾਂ ਦੇ ਅਕਾਊਂਟਾਂ ਵਿੱਚ ਪੈਸੇ ਪਾ ਦਿੰਦੀ ਹੈ ਦੂਸਰੀ ਗੱਲ ਆਪਾਂ ਕਰਾਂਗੇ ਆ ਦੋ ਤਿੰਨ ਸਾਲਾਂ ਵਿੱਚ ਇੱਕ ਸਕੀਮ ਪ੍ਰਧਾਨ ਮੰਤਰੀ ਜਨ ਆਵਾਸ ਯੋਜਨਾ ਦੇ ਤਹਿਤ ਬਹੁਤ ਹੀ ਸਾਰੇ ਬੰਦਿਆਂ ਨੂੰ ਸਰਕਾਰ ਸੈਂਟਰ ਸਰਕਾਰ ਨੇ ਘਰ ਵੀ ਬਣਾ ਕੇ ਦਿੱਤੇ ਹੈ ਅਤੇ ਉਹਨਾਂ ਨੂੰ ਘਰ ਬਣਾਉਣ ਲਈ ਪੈਸੇ ਵੀ ਪਾਏ ਇਸ ਨਾਲ ਬਹੁਤ ਸਾਰੇ ਹੀ ਲਾਭਪਾਤਰੀਆਂ ਨੂੰ ਫਾਇਦਾ ਹੋਇਆ ਪਰ ਆਪਾਂ ਇਹ ਵੀ ਕਹਿ ਸਕਦੇ ਹਾਂ ਕਿ ਇਸ ਦਾ ਜਿਹੜਾ ਫਾਇਦਾ ਹੈ ਉਹ ਜ਼ਿਆਦਾਤਰ ਨੀਵਿਆਂ ਤੋਂ ਉੱਚਿਆਂ ਨੂੰ ਜ਼ਿਆਦਾ ਫਾਇਦਾ ਹੋਇਆ ਨੀਵੀਂ ਸ਼੍ਰੇਣੀ ਨੂੰ ਬਹੁਤ ਘੱਟ ਫਾਇਦਾ ਹੋਇਆ ਜਿਹਨਾਂ ਦੇ ਘਰ ਟੁੱਟੇ ਹੋਏ ਹਨ ਜਿਹਨਾਂ ਦੇ ਬਾਲਿਆਂ ਦੀ ਛੱਤਾਂ ਹੈ ਉਹਨਾਂ ਨੂੰ ਇਹਨਾਂ ਸਕੀਮਾਂ ਬਾਰੇ ਪਤਾ ਹੀ ਨਹੀਂ ਲੱਗਦਾ ਇਸ ਕਰਕੇ ਸਰਕਾਰ ਨੂੰ ਕਿਤੇ ਨਾ ਕਿਤੇ ਚਾਹੀਦਾ ਹੈ ਕਿ ਉਹ ਘਰ ਘਰ ਜਾ ਕੇ ਇਹਨਾਂ ਸਕੀਮਾਂ ਬਾਰੇ ਦੱਸੇ ਤਾਂ ਜੋ ਗਰੀਬ ਵਰਗ ਵੀ ਉੱਭ ਖੁੱਭ ਕੇ ਇਹਨਾ ਸਕੀਮਾਂ ਵਿੱਚ ਆਪਣਾ ਫਾਇਦਾ ਲੈ ਸਕੇ